ਪਸ਼ੂ ਪਾਲਣ ਟਿਕਾਊ ਖੇਤੀ ਅਤੇ ਖੁਰਾਕ ਸੁਰੱਖਿਆ ਵਿੱਚ ਮਹੱਤਵਪੂਰਨ ਯੋਗ ਪਾ ਸਕਦਾ ਹੈ ਕਿਉਂਕਿ ਇਹ ਕਮਿਊਨਿਟੀਆਂ ਨੂੰ ਜਰੂਰੀ ਖੁਰਾਕ ਉਤਪਾਦ ਜਿਵੇਂ ਮੀਟ ਡੈਰੀ ਤੇ ਹੋਰ ਜਾਨਵਰਾਂ ਨੂੰ ਉਤਪਾਤ ਪ੍ਰਧਾਨ ਕਰਦਾ ਹੈ ਇਸ ਨਾਲ ਲੋਕਾਂ ਦੀ ਖੁਰਾਕ ਦੀ ਸੁਰੱਖਿਆ ਵਿੱਚ ਸੁਧਾਰ ਹੁੰਦਾ ਹੈ ਅਤੇ ਇਸੇ ਨਾਲ ਖੇਤੀ ਦੇ ਵਿਕਾਸ ਵਿੱਚ ਸਹਾਰਾ ਮਿਲਦਾ ਹੈ ਪਸ਼ੂ ਪਾਲਣ ਇੱਕ ਸਥਿਰ ਆਰਥਿਕਤਾ ਦੀ ਸਥਾਪਨਾ ਹੋ ਸਕਦੀ ਹੈ ਕਿਉਂਕਿ ਜਾਨਵਰਾਂ ਤੋਂ ਪ੍ਰਾਪਤ ਉਤਪਾਦ ਨੂੰ ਸਥਾਨਕ ਬਾਜ਼ਾਰਾਂ ਵਿੱਚ ਅਧਿਆਪਕ ਵਿਆਪਕ ਵਿਆਪਕ ਵਿਆਪਕ ਕਰਕੇ ਅਸੀਂ ਮਤਲਬ ਆਰਥਿਕ ਵਿੱਚ ਯੋਗਦਾਨ ਪਾਇਆ ਜਾ ਸਕਦਾ ਹੈ ਇਸ ਖੇਤਰ ਵਿੱਚ ਹਜ਼ਾਰਾਂ ਲੋਕ ਸ਼ਾਮਿਲ ਹਨ ਜੋ ਪਸ਼ੂ ਪਾਲਣ ਕਰਦੇ ਹਨ ਜਿਵੇਂ ਮੀਟ ਡੈਰੀ ਉਤਪਾਦ ਡੈਰੀ ਉਤਪਾਦ ਕਰਨ ਦੇ ਨਾਲ ਕੀ ਹੁੰਦਾ ਆ ਕਿ ਲੋਕਾਂ ਨੂੰ ਆਮਦਨ ਦੁੱਧ ਵੀ ਮਿਲਦਾ ਆ ਤੇ ਹਨਾ ਪੈਸੇ ਵੀ ਚੰਗੇ ਕਮਾ ਲੈਂਦੇ ਨੇ ਤੇ ਹੋਰ ਜਾਨਵਰਾਂ ਦੇ ਉਤਪਾਦਾਂ ਦਾ ਵੀ ਉਤਪਾਦਨ ਉਤਪਨ ਤੇ ਵਹਿੰਦੇ ਹਨ ਖੇਤੀ ਤੇ ਪਸ਼ੂ ਪਾਲਣ ਦੇ ਕਾਰੋਬਾਰ ਨਾਲ ਲੋਕਾਂ ਨੂੰ ਧਨ ਵੀ ਧਨ ਵੱਧ ਧੰਨ ਵੀ ਵੱਧਦਾ ਆ ਤੇ ਖੁਰਾਕ ਦੀ ਉਹ ਸੁਰੱਖਿਆ ਵਿੱਚ ਵੀ ਸੁਧਾਰ ਹੁੰਦਾ ਹੈ ਜੇਕਰ ਤੁਸੀਂ ਇਸ ਖੇਤਰ ਵਿੱਚ ਬਿਹਤਰ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਕੁਝ ਉਹ ਉਹ ਅਹੰਕਾਰਕ ਤਰੀਕਿਆਂ ਨੂੰ ਅਪਣਾਉਣਾ ਚਾਹੀਦਾ ਹੈ ਉਹ ਮਿਆਰੀ ਖੁਰਾਕ ਪੂਰਾ ਕਰਨਾ ਪਸ਼ੂ ਪਾਲਣ ਦੁੱਧ ਪਾਦ ਨੂੰ ਸਥਿਰ ਤੇ ਗੁਣਵੱਤਾ ਵਾਲਾ ਕਰਨਾ ਸਸਤੀ ਤੇ ਪ੍ਰਭਾਵਸ਼ਾਲੀ ਖੇਤੀ ਤਕਨੀਕਾਂ ਨੂੰ ਟੈਕਨਾਊ ਖੇਤੀ ਲਈ ਤਰੀਕਿਆਂ ਨੂੰ ਬਣਾਉਣਾ ਜਿਵੇਂ ਜਿਆਦਾ ਉਤਪਾਦ ਤੇ ਘੱਟ ਖਰਚੇ ਸੁਧਾਰਨ ਤਰੀਕਿਆਂ ਨੂੰ ਪ੍ਰਚਾਰਿਤ ਕਰਨਾ ਪਸ਼ੂ ਸਿਹਤ ਤੇ ਧਿਆਨ ਦੇਣ ਵਾਲੀਆਂ ਸਿਹਤਮੰਦ ਅਤੇ ਬਿਮਾਰ ਰਹਿਤ ਪਸ਼ੂ ਵਧੇਰੇ ਉਤਪਾਦ ਪ੍ਰਦਾਨ ਕਰਦੇ ਹਨ ਇਸ ਲਈ ਪਸ਼ੂ ਜਿਹੜੇ ਆ ਪਸ਼ ਪਸ਼ੂ ਸਿਹਤ ਅਤੇ ਸੰਭਾਲ ਤੇ ਧਿਆਨ ਦਿਓ ਟਿਕਾਉ ਛੇਤੀ ਅਤੇ ਦੀ ਵਰਤੋਂ ਕਰੋ ਤੇ ਖੇਤੀ ਤਕਨੀਕਾਂ ਦੇ ਵਿੱਚ ਪਰਿਵਰਤਨ ਲਿਆਉਣਾ ਚਾਹੀਦਾ ਹੈ ਇਸ ਤਰੀਕੇ ਨਾਲ ਸਾਨੂੰ ਇਸ ਖੇਤਰ ਦੇ ਵਿੱਚ ਪ੍ਰਮੁੱਖ ਸਥਾਨ ਪ੍ਰਾਪਤ ਹੋਣ ਦੇ ਵਿੱਚ ਮਦਦ ਮਿਲਦੀ